ਹਾਂਜੀ ਮੈਂ ਕੱਲ੍ਹ ਤੁਹਾਡੇ ਕੋਲੋਂ ਦੋ ਦੋ ਪਿੱਜ਼ਾ ਅਤੇ ਦੋ ਹੀ ਔਡਰ ਲਏ ਸੀ ਹੋਰ ਜਿਹਦੇ ਵਿੱਚ ਕਿ ਇੱਕ ਭਰਾਓ ਸੀ ਗਾਰਲਿਕ ਬਰੈਡ ਸੀ ਔਰ ਨਾਲ ਇੱਕ ਕੋਕ ਸੀ ਉਹ ਬਹੁਤ ਵਧੀਆ ਰਹੀ ਪਰ ਮੈਨੂੰ ਉਹਦੀ ਰਸੀਦ ਚਾਹੀਦੀ ਸੀ ਕਿਉਂਕਿ ਜਿਹੜੀ ਕੰਪਨੀ ਦੇ ਥਰੂ ਮੈਂ ਤੁਹਾਡੇ ਵੱਲ ਕੱਲ੍ਹ ਆਈ ਸੀ ਉਹਨਾਂ ਨੇ ਉਹ ਮੈਨੂੰ ਪੇ ਕਰਨੀ ਹੈ ਅਤੇ ਜਿਹਦੇ ਕਰਕੇ ਮੈਨੂੰ ਤੁਹਾਡੇ ਕੋਲੋਂ ਉਹ ਰਸੀਦ ਚਾਹੀਦੀ ਹੈ ਜਿਹੜੀ ਰਸੀਦ ਮੇਰੇ ਕੋਲ ਕੱਲ੍ਹ ਸੀ ਉਹ ਮੇਰੀ ਗੁਆਚ ਗਈ ਹੈ ਅਤੇ ਮੈਂ ਚਾਵਾਂਗੀ ਕਿ ਤੁਸੀਂ ਮੈਨੂੰ ਉਹੀ ਰਸੀਦ ਦੁਬਾਰਾ ਦੇ ਦਿਓ ਤੁਹਾਡੀ ਬੜੀ ਕ੍ਰਿਪਾਲਤਾ ਹੋਵੇਗੀ